ਮੈਂ ਫਤਿਹਗੜ੍ਹ ਸਾਹਿਬ ਵਿੱਚ ਰਹਿੰਦਾ ਇੱਥੇ ਬਹੁਤ ਸਾਰੀਆਂ ਪਰਚੋਣ ਦੀਆਂ ਅਤੇ ਥੋਕ ਦੀਆਂ ਦੁਕਾਨਾਂ ਹਨ ਮੇ ਜਿੱਥੋਂ ਅਸੀਂ ਸੌਦਾ ਮੈਂ ਸੌਦਾ ਖਰੀਦਦਾ ਹਾਂ ਰਾਸ਼ਨ ਘਰ ਦਾ ਕਰਿਆਨਾ ਉਹ ਸਰਰੰਦ ਦੇ ਵਿੱਚ ਫੁਆਰਾ ਚੌਂਕ ਦੇ ਕੋ ਵਿੱਚ ਕੋਲੇ ਇੱਕ ਦੁਕਾਨ ਹੈ ਜਿਸਦਾ ਨਾਮ ਹੈ ਬੰਸੀ ਲਾਲ ਕਰਿਆਨਾ ਸਟੋਰ ਇਹਨਾਂ ਦਾ ਜਿਹੜਾ ਜਿਹੜੇ ਡੀਲਿੰਗ ਕਰਨ ਦਾ ਤਰੀਕਾ ਹੈ ਬਹੁਤ ਹੀ ਵਧੀਆ ਹੈ ਅਤੇ ਜੋ ਵੀ ਅਸੀਂ ਕਰਿਆਨਾ ਰਾਸ਼ਨ ਖਰੀਦਦੇ ਹਾਂ ਉਹ ਬਹੁਤ ਵਧੀਆ ਕੁਆਲਿਟੀ ਦੀਆਂ ਮਿਲਦੀਆਂ ਨੇ ਇੱਥੋਂ ਦਾਲਾਂ ਜਾਂ ਜੋ ਵੀ ਹੋਰ ਸਮਾਨ ਹੈ ਰਾਸ਼ਨ ਦਾ ਅਤੇ ਜਿਹੜੀਆਂ ਇਹਨਾਂ ਦੇ ਰੇਟ ਵੀ ਜਿਹੜੇ ਹੈ ਸਾਰੇ ਬਾਜ਼ਾਰ ਨਾਲੋਂ ਬਹੁਤ ਜਾਇਜ਼ ਹੁੰਦੇ ਨੇ ਨੋਮੀਨਲ ਚਾਰਜ਼ਸ ਨੇ ਇਹਨਾਂ ਦੇ ਸਾਰੇ ਅਤੇ ਕੁਆਲਿਟੀ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਇਹਨਾਂ ਦੀ ਅਤੇ ਅਸੀਂ ਜਿਹੜੀਆਂ ਬਾਕੀ ਹੋਰ ਜਿਹੜੀਆਂ ਸਬਜ਼ੀਆਂ ਵਗੈਰਾ ਹੈ ਉਹ ਅਸੀਂ ਇੱਥੋਂ ਲੋਕਲ ਮਾਰਕੀਟ ਜਿਹੜੀ ਸਾਡੀ ਔਨਲਾਈਨ ਇੱਥੇ ਫਰੈਸ਼ ਜਿਹੜੀ ਸਾਨੂੰ ਮਿਲ ਜਾਂਦੀ ਹੈ ਸਬਜੀਜ਼ੀ ਉੱਥੋਂ ਅਸੀਂ ਖਰੀਦ ਲੈਂਦੇ ਹਾਂ ਜਿਹੜੀ ਸਾਨੂੰ ਚਾਹੀਦੀ ਹੁੰਦੀ ਹੈ ਅਸੀਂ ਇਕੱਠੀ ਸਬਜ਼ੀ ਨਹੀਂ ਲੈ ਕੇ ਆਉਂਦੇ ਰੋਜ਼ ਦੀ ਰੋਜ਼ ਜਿੰਨੀ ਸਾਨੂੰ ਚਾਹੀਦੀ ਹੁੰਦੀ ਹੈ ਫਰੈਸ਼ ਸਬਜ਼ੀ ਅਸੀਂ ਲੈ ਆਉਂਦੇ ਹਾਂ ਕਿਉਂਕਿ ਉਹ ਜਿਹੜੀ ਖੇਤਾਂ ਦੇ ਵਿੱਚੋਂ ਬੰਦੇ ਜਿਹੜੇ ਬੀਜ ਕੇ ਤਿਆਰ ਕਰਕੇ ਆਪਣੀਆਂ ਔਰਗੈਨਿਕ ਸਬਜ਼ੀਆਂ ਵੇਚਦੇ ਨੇ ਉਹ ਅਸੀਂ ਇੱਥੋਂ ਲੈ ਲੈਂਦੇ ਜਿਹੜੀ ਸਾਨੂੰ ਚਾਹੀਦੀ ਹੁੰਦੀ ਹੈ